ਮੈਂ ਹਰ ਇੱਕ ਪਕਵਾਨ ਬਣਾਉਣ 'ਚ ਬਹੁਤ ਹੀ ਟੈਲੈਂਟਿਡ ਹਾਂ ਅਤੇ ਮੈਨੂੰ ਕੁਕਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਮੈਨੂੰ ਸਾਰੇ ਪਕਵਾਨ ਬਣਾਉਣੇ ਬਹੁਤ ਹੀ ਚੰਗੀ ਤਰ੍ਹਾਂ ਆਉਂਦੇ ਹਨ ਮੇਰੀ ਮੰਮੀ ਨੇ ਜਦ ਕਿ ਮੈਨੂੰ ਛੋਟੀ ਹੁੰਦੀ ਤੋਂ ਹੀ ਸਿਖਾਉਣਾ ਸਟਾਰਟ ਕਰਤਾ ਸੀਗਾ ਬਟ ਮੈਂ ਸਭ ਤੋਂ ਜ਼ਿਆਦਾ ਬਣਾਉਣ 'ਚ ਮੈਗੀ ਐਂਡ ਯੈਲੋ ਰਾਈਸ ਬਣਾਉਣ 'ਚ ਬਹੁਤ ਜ਼ਿਆਦਾ ਟੈਲੈਂਟਿਡ ਹਾਂ ਅਤੇ ਮੇਰੇ ਘਰਦਿਆਂ ਨੂੰ ਦੋਨੋਂ ਚੀਜ਼ਾਂ ਬਣਾਈਆਂ ਹੋਈਆਂ ਐਨੀਆਂ ਜ਼ਿਆਦਾ ਪਸੰਦ ਆਉਂਦੀਆਂ ਕਿ ਮੇਰੇ ਸਾਰੇ ਭੈਣ ਭਾਈ ਜਦੋਂ ਵੀ ਅਸੀਂ ਇਕੱਠੇ ਹੁੰਦੇ ਹਾਂ ਸਾਡੀ ਸਿਵਲਿੰਗ ਤਾਂ ਸਾਰੇ ਮੈਨੂੰ ਕਹਿੰਦੇ ਤੂੰ ਉਹ ਡਿਸ਼ ਬਣਾ ਕੇ ਸਾਨੂੰ ਖਿਲਾ ਅਤੇ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੂੰ ਬਣਾਉਂਦੀ ਹਾਂ ਅਤੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਬਣਾਉਣ 'ਚ ਟਾਈਮ ਇਸ ਲਈ ਲੱਗਦਾ ਕਿਉਂਕਿ ਮੈਂ ਹਰ ਇੱਕ ਵੈਜੀਟੇਬਲਜ਼ ਉਹਨਾਂ ਦੇ ਵਿੱਚ ਐਡ ਆਨ ਕਰਦੀ ਹਾਂ ਉਹ ਵੀ ਬੜੀਆਂ ਹੀ ਛੋਟੀ ਛੋਟੀਆਂ ਕਰਕੇ ਮਿਕਸ ਅਪ ਕਰਕੇ ਅਤੇ ਸਾਰੇ ਹੀ ਖਾ ਕੇ ਉਹਨੂੰ ਬੜਾ ਖੁਸ਼ ਹੁੰਦੇ ਹਨ ਅਤੇ ਸਾਰੇ ਹੀ ਬਣੇ ਉਹ ਭੋਜਨ ਨੂੰ ਮੇਰੇ ਨੂੰ ਬਹੁਤ ਹੀ ਪਸੰਦ ਕਰਦੇ ਹਨ